ਮੇਰਾ ਔਨਲਾਈਨ ਸ਼ੋਪਿੰਗ ਦਾ ਵੈਸੇ ਤਾਂ ਵਧੀਆ ਐਕਸਪੀਰੀਅੰਸ ਰਿਹਾ ਲੇਕਿਨ ਸਿਰਫ ਇੱਕੋ ਹੀ ਮੇਰਾ ਬਹੁਤ ਖ਼ਰਾਬ ਨੈਗੇਟਿਵ ਐਕਸਪੀਰੀਅੰਸ ਰਿਹਾ ਜੋ ਕਿ ਜੈਕਟ ਬਾਰੇ ਆ ਉਹ ਮੈਂ ਐੱਚ ਐਂਡ ਐੱਮ ਤੋਂ ਔਨਲਾਈਨ ਮੰਗਵਾਈ ਸੀਗੀ ਕਿਉਂਕਿ ਮੇਰੇ ਮੇਰੇ ਨਾਲ ਜੋ ਮੇਰੀ ਇੱਕ ਫਰੈਂਡ ਪੜ੍ਹਦੀ ਆ ਉਹਦੀ ਬਰਦਡੇ ਪਾਰਟੀ ਸੀ ਤਾਂ ਮੈਂ ਉਹਦੇ ਬਰਦਡੇ ਪਾਰਟੀ 'ਤੇ ਪਾ ਕੇ ਜਾਣੀ ਸੀ ਸੋ ਉਹ ਆਡਰ ਪਹੁੰਚਿਆ ਵੀ ਪਹਿਲੀ ਗੱਲ ਉਹਦੇ ਬਰਦਡੇ ਪਾਰਟੀ ਤੋਂ ਸਿਰਫ਼ ਦੋ ਦਿਨ ਪਹਿਲਾਂ ਤੇ ਉਹ ਜਦੋਂ ਜੈਕਟ ਆਈ ਮੈਂ ਬਹੁਤ ਐਕਸਾਈਟਿਡ ਸੀ ਬਟ ਜਦੋਂ ਮੈਂ ਉਹਨੂੰ ਓਪਨ ਕੀਤਾ ਉਹਦੀ ਪੈਕਜ਼ਿੰਗ ਵੀ ਇੰਨੀ ਵਧੀਆ ਨਹੀਂ ਸੀਗੀ ਰਫਲੀ ਪੈਕ ਕੀਤੀ ਹੋਈ ਸੀ ਅਤੇ ਜਦੋਂ ਉਹਨੂੰ ਓਪਨ ਕੀਤਾ ਤਾਂ ਉਹਦੀ ਜਿਹੜੀ ਫਿਟਿੰਗ ਸੀ ਉਹ ਵੀ ਪ੍ਰੋਪਰ ਨਹੀਂ ਸੀ ਪਲੱਸ ਉਹਦਾ ਜੋ ਮੈਟੀਰੀਅਲ ਸੀ ਉਹ ਇੰਨਾ ਵਧੀਆ ਕੁਆਲਿਟੀ ਦਾ ਨਹੀਂ ਸੀ ਐਂਡ ਜੋ ਉਹਦਾ ਜ਼ਿਪਰ ਸੀ ਉਹ ਵੀ ਸਮੂਦਲੀ ਕੰਮ ਨਹੀਂ ਕਰ ਰਿਹਾ ਸੀ ਅਟਕ ਰਿਹਾ ਸੀ ਬਾਰ ਬਾਰ ਅਤੇ ਉਹਦਾ ਉਹ ਡਿਫਰੈਂਟਲੀ ਸ਼ੇਡ ਮਾਰ ਰਹੀ ਸੀਗੀ ਹਾਫ ਸਾਈਡ ਜੈਕਟ ਸੇਮ ਅੱਡ ਛੇਡ ਦੀ ਸੀ ਹਾਫ ਸਾਈਡ ਅੱਡ ਸ਼ੇਡ ਦੀ ਸੀਗੀ ਕਲਰ ਸੇਮ ਸੀ ਬਟ ਸ਼ੇਡਿੰਗ ਪ੍ਰੋਬਲਮ ਸੀ ਉੱਪਰੋਂ ਜੇ ਆਪਾਂ ਸਟਿਚਿੰਗ ਦੀ ਗੱਲ ਕਰੀਏ ਤਾਂ ਉਹਦੀਆਂ ਸਿਊਣਾ ਵੀ ਐਨ ਕੱਚ ਕੱਚੀਆਂ ਸੀਗੀਆਂ ਉੱਧੜ ਰਹੀਆਂ ਸੀਗੀਆਂ ਅਤੇ ਫਿਰ ਮੈਂ ਉਹ ਕੰਪਨੀ ਨੂੰ ਦੁਬਾਰਾ ਵਾਪਸ ਕਰਤੀ ਰਿਟਰਨ ਕਰਤੀ ਅਤੇ ਮੈਂ ਰੀਫੰਡ ਲੈ ਲਿਆ ਸੀਗਾ